ਦੇਖੋ ਅਜਿਹੇ ਵਿਅਕਤੀ ਨੂੰ ਮੈਂ ਇਹੀ ਸਲਾਹ ਦੇਵਾਂਗੀ ਕਿ ਉਹ ਛੱਡੇ ਨਾ ਇਹ ਕਲਾ ਕਈ ਵਾਰੀ ਕੀ ਹੁੰਦਾ ਹੈ ਕਿ ਸ਼ੁਰੂਆਤ ਜਦੋਂ ਕਰਦੇ ਹਾਂ ਪਹਿਲਾਂ ਤਾਂ ਮਜ਼ਾ ਆਉਂਦਾ ਕਹਿੰਦਾ ਬਾਅਦ 'ਚੋ ਡਰ ਲੱਗਦਾ ਕਿ ਇਹ 'ਚ ਹਾਂ ਕੋਈ ਸਪੋਰਟ ਹੈਗਾ ਕਿ ਨਹੀਂ ਆ ਅੱਗੇ ਜਾ ਕੇ ਫਿਊਚਰ 'ਚ ਕੀ ਬਣੂਗਾ ਕੀ ਨਹੀਂ ਬਣੂਗਾ ਫਿਊਚਰ ਦੀ ਫਿਊਚਰ 'ਚ ਦੇਖੀ ਜਾਏਗੀ ਜੋ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਪਹਿਲਾਂ ਉਹ ਤਾਂ ਕਰ ਲਓ ਅਜਿਹੇ ਵਿਅਕਤੀ ਨੂੰ ਮੈਂ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਚਿੱਤਰਕਾਰੀ ਤੋਂ ਹੀ ਸ਼ੁਰੂ ਕੀਤੀ ਹੈ ਆਪਣੇ ਹੁਨਰ ਨੂੰ ਸੁਧਾਰੋ ਬਾਰ ਬਾਰ ਉਹਦੀ ਪ੍ਰੈਕਟਿਸ ਕਰੋ ਜਿਹੜੀ ਚੀਜ਼ ਨਹੀਂ ਬਣਦੀ ਆ ਉਹਨੂੰ ਸਮਝ ਕੇ ਉਹਦਾ ਤਰੀਕਾ ਦੇਖੋ ਉਹਨੂੰ ਸ਼ੁਰੂ ਕਿੱਦਾਂ ਕਰੀਏ ਅੱਜ ਕੱਲ੍ਹ ਤਾਂ ਇੰਟਰਨੈੱਟ 'ਤੇ ਬਹੁਤ ਸਾਧਨ ਹਨ ਹੁਣ ਸਾਰੀਆਂ ਸਹੂਲਤਾਂ ਸਾਨੂੰ ਪ੍ਰੋਵਾਈਡ ਸਾਰਿਆਂ ਕੋਲ ਫੋਨ ਹੁੰਦੇ ਆ ਆਪਣੇ ਆਪਣੇ ਹੈ ਨਾ ਅਤੇ ਸਾਰੇ ਮਤਲਬ ਕਿ ਹਰ ਇੱਕ ਚੀਜ਼ ਪੋਸੀਬਲ ਆ ਹੁਣ ਕਰਨੀ ਕੋਈ ਲੋਕ ਚੰਦ ਚੰਦ ਤੱਕ ਚੱਲ ਗਏ ਅਤੇ ਅਸੀਂ ਚਿੱਤਰਕਾਰੀ ਨਹੀਂ ਕਰ ਸਕਦੇ ਅਤੇ ਇੰਟਰਨੈੱਟ ਯੂਟੀਊਬ ਖੋਲ੍ਹੋ ਉੱਥੇ ਦੇਖੋ ਕਿ ਉਹਨਾਂ ਨੇ ਕਿੱਦਾਂ ਬਣਾਇਆ ਤੁਸੀਂ ਵੀ ਅਭਿਆਸ ਕਰੋ ਚੰਗੀ ਤਰ੍ਹਾਂ ਅਭਿਆਸ ਕਰੋ ਅਤੇ ਇੱਕ ਹੋਰ ਗੱਲ ਹੁੰਦੀ ਹੈ ਕਿ ਕਦੀ ਵੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕੋਈ ਕਹਿ ਦਏ ਕਿ ਤੈਨੂੰ ਆਉਂਦੀ ਨਹੀਂ ਹੈ ਤੂੰ ਕਿੱਦਾਂ ਕਰ ਲਏਗਾ ਕਹਿ ਮੈਂ ਕਰਲਾਂਗਾ ਤੁਸੀਂ ਟਰਾਏ ਕਰੋਗੇ ਤੱਕ ਤੁਸੀਂ ਟਰਾਈ ਨਹੀਂ ਕਰੋਗੇ ਤੁਹਾਨੂੰ ਨਹੀਂ ਆਏਗੀ ਬਾਰ ਬਾਰ ਗਲਤ ਕਰੋਗੇ ਬਾਰ ਬਾਰ ਉਹਨੂੰ ਸੁਧਾਰੋਗੇ ਜਿਹੜੀ ਵੀ ਪਿੱਛੇ ਗਲਤੀ ਕੀਤੀ ਉਹ ਅਗਲੀ ਵਾਰੀ ਨਹੀਂ ਕਰੋਗੇ ਤੁਸੀਂ ਅਗਲੀ ਵਾਰੀ ਉਹਨੂੰ ਸੁਧਾਰ ਲਓਗੇ ਸੋ ਜਿੰਨੀ ਪ੍ਰੈਕਟਿਸ ਆ ਉਨੀ ਕਰਨੀ ਚਾਹੀਦੀ ਹੈ ਅਤੇ ਛੱਡਣਾ ਬਿਲਕੁਲ ਨਹੀਂ ਜੇ ਤੁਹਾਨੂੰ ਪਸੰਦ ਆ ਤਾਂ ਬਿਲਕੁਲ ਨਾ ਛੱਡੋ ਹਮੇਸ਼ਾ ਉਹਨੂੰ ਫੋਲੋ ਕਰਨਾ ਚਾਹੀਦਾ ਆਪਣੇ ਡਰੀਮਸ ਨੂੰ ਫੋਲੋ ਕਰੋ ਜੇ ਤੁਸੀਂ ਇਹ ਲੈਨ ਚੁਣੀ ਹੈ ਤਾਂ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਲੈਨ ਹੈ ਇਹ ਅੱਗੇ ਬਹੁਤ ਫਿਊਚਰ ਹੁੰਦਾ ਆ ਹਾਂ ਸਾਡੇ ਇੰਡੀਆ ਵਿੱਚ ਇੰਨਾ ਕੁ ਨਹੀਂ ਹੈ ਪਰ ਬਾਹਰਲੀ ਕੰਟਰੀ 'ਚ ਇਹਦਾ ਬਹੁਤ ਮਹੱਤਵ ਹੈ ਤੁਸੀਂ ਚਾਹੋ ਇੰਟਰਨੈਸ਼ਨਲ ਲੈਵਲ 'ਤੇ ਫੈਸਟੀਵ ਵਿੱਚ ਕਰੋ ਪਾਰਟੀਸਪੇਟ ਕਰੋ ਉਹਨਾਂ ਵਿੱਚ ਭਾਗ ਲਓ ਅਤੇ ਆਪਣੀ ਜਿਹੜੀ ਕਲਾ ਆ ਉਹਨੂੰ ਪ੍ਰਦਰਸ਼ਿਤ ਕਰੋ ਅਤੇ ਇੱਕ ਹੋਰ ਗੱਲ ਜਦੋਂ ਤੁਸੀਂ ਬੇਸਿਕ ਤੋਂ ਸ਼ੁਰੂ ਕਰਦੇ ਹੋ ਤੁਹਾਨੂੰ ਤੁਹਾਨੂੰ ਬਹੁਤ ਧਿਆਨ ਨਾਲ ਸਿੱਖਣੇ ਪੈਣੇ ਕਿ ਅਸੀਂ ਸਟਰੋਕ ਕਿਵੇਂ ਮਾਰਦੇ ਹਾਂ ਜਾਂ ਇਹ ਪੈਨਸਿਲ ਕਿਹੜੀ ਯੂਸ ਕੀਤੀ ਹੁਣ ਪੈਨਸਿਲਾਂ ਕਈ ਤਰ੍ਹਾਂ ਦੀਆਂ ਆਉਂਦੀਆ ਤੁਸੀਂ ਇੱਕੋ ਪੈਨਸਲ ਨਾਲ ਕਈ ਛੇਡ ਦੇ ਸਕਦੇ ਹੋ ਬਸ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਹੈ ਸੋ ਜਾਂ ਤੁਸੀਂ ਇੱਦਾਂ ਆਪਣੀਆਂ ਚੀਜ਼ਾਂ ਨੂੰ ਸੁਧਾਰ ਸਕਦੇ ਹੋ ਆਪਣੇ ਹੁਨਰ ਨੂੰ ਸੁਧਾਰ ਸਕਦੇ ਹੋ